ਹਾਂਜੀ ਬੋਲੀਵੁੱਡ ਟੋਲੀਵੁੱਡ ਨੇ ਭਾਰਤ ਵਿੱਚ ਹਰ ਥਾਂ ਫੈਸ਼ਨ ਰੁਝਾਵਾਂ ਨੂੰ ਪ੍ਰਭਾਵਿਤ ਕੀਤਾ ਹੈ ਕੁਝ ਫਿਲਮ ਪਾਤਰ ਹਨ ਜਿਹਨਾਂ ਦੇ ਕੱਪੜਿਆਂ ਦੀ ਸ਼ੈਲੀ ਮੈਂ ਬਹੁਤ ਪਸੰਦ ਕਰਦੀ ਹਾਂ ਪਰ ਮੈਨੂੰ ਹਾਲੇ ਉਹਨਾਂ ਦੇ ਨਾਮ ਯਾਦ ਨਹੀਂ ਹਨ ਅਤੇ ਮੈਂ ਕਿਸੇ ਫਿਲਮ ਤੋਂ ਸਮਾਨ ਪਹਿਰਾਵਾ ਬਣਾਉਣ ਦੀ ਹਾਲੇ ਤੱਕ ਕੋਸ਼ਿਸ਼ ਨਹੀਂ ਕੀਤੀ ਹੈ ਲੇਕਿਨ ਮੈਨੂੰ ਉਹਨਾਂ ਦਾ ਪਹਿਰਾਵਾ ਜਿਹੜਾ ਆ ਉਹ ਬਹੁਤ ਪਸੰਦ ਹੈਗਾ ਆ ਅਤੇ ਮੈਂ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਦੇ ਪਹਿਰਾਵੇ ਨੂੰ ਦੇਖ ਕੇ ਸਮਾਨ ਪਹਿਰਾਵਾ ਸੇਮ ਉਹਨਾਂ ਵਰਗਾ ਬਣਾ ਸਕਾਂ ਹਾਲੇ ਮੇਰੇ ਤੋਂ ਸਮਾਨ ਦੀ ਕਮੀ ਹੋਣ ਕਰਕੇ ਹਾਲੇ ਮੈਂ ਇਹ ਕੋਸ਼ਿਸ਼ ਨਹੀਂ ਕਰ ਸਕਦੀ ਆਉਣ ਵਾਲੇ ਸਮੇਂ ਵਿੱਚ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਦੇ ਬਿਲਕੁਲ ਸਮਾਨ ਪਹਿਰਾਵਾ ਬਣਾ ਸਕਾਂ ਧੰਨਵਾਦ ਜੀ